ਮੈਨੂੰ ਨਹੀਂ ਲੱਗਦਾ ਕਿ ਭੰਗੜਾ ਗਾਂਹ ਜਾ ਕੇ ਅਲੋਪ ਹੋਊਗਾ ਮੈਂ ਸਮਝਦੀ ਹਾਂ ਕਿ ਇਦੂ ਵਧੀਆ ਇਦੂ ਵੱਧ ਕੇ ਲੋਕ ਇਹਨੂੰ ਭੰਗੜੇ ਨੂੰ ਮਹੱਤਤਾ ਦੇਣਗੇ ਅੱਜ ਕੱਲ੍ਹ ਲੋਕੀ ਫੇਸਬੁਕਾਂ ਸ਼ੇਅਰਚੈਟਾਂ 'ਤੇ ਇਹਨਾਂ ਦੇ ਭੰਗੜੇ ਪਾਉਂਦੇ ਹਨ ਅਤੇ ਲੋਕ ਕੋਚ ਵੀ ਇਹਨਾਂ ਭੰਗੜਿਆਂ ਨੂੰ ਮਹੱਤਤਾ ਦਿੰਦੇ ਆ ਲੋਕ ਕੋਚਾਂ ਤੋਂ ਸਿੱਖਣ ਲਈ ਟ੍ਰੇਨਿੰਗ ਲੈਂਦੇ ਹਨ ਕੁੜੀਆਂ ਮੁੰਡੇ ਸਾਰੇ ਹੀ ਭੰਗੜੇ ਪਾ ਲੈਂਦੇ ਹਨ ਅੱਜ ਕੱਲ੍ਹ ਵਿਆਹ ਸ਼ਾਦੀ ਵਿੱਚ ਬਹੁਤ ਜ਼ਿਆਦਾ ਭੰਗੜੇ ਦਾ ਇਸਤੇਮਾਲ ਕੀਤਾ ਜਾਂਦਾ ਜਦੋਂ ਮੁੰਡਾ ਹੋ ਜਾਂਦਾ ਤਾਂ ਲੋਕੀ ਭੰਗੜੇ ਪਾਉਂਦੇ ਹਨ ਇਦੂ ਵੱਧ ਲੋਕੀ ਜ਼ਿਆਦਾ ਭੰਗੜੇ ਦੀ ਮਹੱਤਤਾ ਦਿੰਦੇ ਹਨ ਕੁੜੀਆਂ ਮੁੰਡੇ ਜ਼ਿਆਦਾ ਭੰਗੜਾ ਪਾਉਂਦੇ ਹਨ ਕੁੜੀਆਂ ਸਲਵਾਰ ਸੂਟ ਸੱਗੀ ਫੁੱਲ ਲਾ ਕੇ ਭੰਗੜਾ ਪਾਉਂਦੀਆਂ ਹਨ ਮੁੰਡੇ ਤੁਰਲੇ ਦੀ ਪੱਗ ਪਜਾਮਾ ਕੁੜਤਾ ਵਿੱਚ ਪਾਉਂਦੇ ਹਨ ਅਤੇ ਭੰਗੜਾ ਪਾਉਂਦੇ ਹਨ ਕੋਚਾਂ ਵਗੈਰਾ ਤੋਂ ਸਿੱਖਦੇ ਹਨ ਕੋਚ ਉਹਨਾਂ ਨੂੰ ਸਿਖਾਉਂਦੇ ਹਨ ਭੰਗੜਾ ਇੱਕ ਪ੍ਰਸਿੱਧ ਲੋਕ ਨਹੀਂ ਹੋ ਸਕਦਾ ਇਦੂ ਗਾਂਹ ਭੰਗੜੇ ਦੀ ਮਹੱਤਤਾ ਜ਼ਿਆਦਾ ਦਿੱਤੀ ਜਾਊਗੀ ਲੋਕ ਬੱਚੇ ਵੀ ਅੱਜ ਕੱਲ੍ਹ ਭੰਗੜੇ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਲੋਕੀ ਸਕੂਲਾਂ ਕਾਲਜਾਂ ਵਿੱਚ ਵੀ ਭੰਗੜੇ ਦੀ ਕਰਾਈ ਜਾਂਦੇ ਹਨ ਲੋਕ ਇੰਟਰਨੈਟ ਵਿੱਚ ਵੀ ਭੰਗੜੇ ਦਾ ਸਭ ਤੋਂ ਵੱਧ ਮਹੱਤਵ ਦਿੱਤੀ ਜਾਂਦੀ ਹੈ ਭੰਗੜਾ ਹੀ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਪੰਜਾਬ ਵਿੱਚ ਭੰਗੜੇ ਦਾ ਜ਼ਿਆਦਾ ਹੀ ਮਹੱਤਵ ਦਿੱਤੀ ਜਾਂਦੀ ਹੈ ਲੋਕ ਅੱਜ ਕੱਲ੍ਹ ਬਾਹਰਲੇ ਸ਼ਹਿਰਾਂ ਵਿੱਚ ਵੀ ਭੰਗੜੇ ਨੂੰ ਹੀ ਜ਼ਿਆਦਾ ਮਹੱਤਵ ਦਿੱਤੀ ਜਾਂਦੀ ਆ ਅਤੇ ਭੰਗੜੇ ਤੋਂ ਲੋਕ ਜ਼ਿਆਦਾ ਕੁਛ ਸਿੱਖ ਰਹੇ ਹਨ ਲੋਕ ਅੱਜ ਕੱਲ੍ਹ ਇਹਨਾਂ ਚੀਜ਼ਾਂ ਤੋਂ ਬਾਹਰ ਹੁੰਦੇ ਜਾ ਰਹੇ ਹਨ ਅਤੇ ਭੰਗੜਾ ਜ਼ਰੂਰੀ ਮੰਨ ਕੇ ਚ ਚੱਲਿਆ ਜਾਂਦਾ ਹੈ